ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਮੈਮ ਡੀ ਪੀ ਐੱਸ ਇੰਟਰਨੈਸ਼ਨਲ ਸਕੂਲ ਤੋਂ ਬੋਲ ਰਹੇ ਹੋ ਮੈਮ ਤੁਹਾਡੇ ਮੈਂ ਅਖ਼ਬਾਰ ਦੇ ਵਿੱਚ ਵਕੈਂਸੀ ਦੇਖੀ ਸੀ ਜੇ ਬੀ ਟੀ ਟੀਚਰ ਦੀ ਰਿਕੁਆਇਰਮੈਂਟ ਦੇ ਲਈ ਹਾਂਜੀ ਮੈਮ ਮੇਰਾ ਨਾਮ ਕਿਰਨਜੋਤ ਕੌਰ ਹੈ ਮੈਮ ਐਕਚੁਲੀ ਮੈਂ ਬੁਢਲਾਢਾ ਤੋਂ ਬੋਲ ਰਹੀ ਹਾਂ

ਹਾਂਜੀ ਮੈਮ ਮੈਂ ਐੱਮ ਐੱਸ ਸੀ ਕੈਮਿਸਟਰੀ ਹਾਂ ਮੈਂ ਸੈਂਟਰਲ ਯੂਨੀਵਰਸਿਟੀ ਔਫ ਪੰਜਾਬ ਤੋਂ ਆਪਣੀ ਡਿਗਰੀ ਕੰਪਲੀਟ ਕੀਤੀ ਹੈ ਮੈਂ ਮੈਂ ਜੇ ਆਰ ਐਫ ਹੋਲਡਰ ਵੀ ਹਾਂ ਮੈਂ ਵੀ ਕੈਮਿਸਟਰੀ ਦੇ ਵਿੱਚ ਆਪਣੀ ਪੀ ਟੀ ਕੀਤੀ ਹੈ ਮੈਮ ਮੈਂ ਪਲੱਸ ਵਨ ਪਲੱਸ ਟੂ ਨੂੰ ਪ੍ਰੈਫਰ ਕਰਾਂਗੀ ਹਾਂਜੀ ਮੈਮ ਪੇਅ ਐਕਸਪੇਕਟੇਸ਼ਨਸ ਮੈਮ ਮੈਂ ਪੈਂਤੀ ਤੋਂ ਚਾਲੀ ਹਜ਼ਾਰ ਰੁਪਏ ਰੱਖਦੀ ਹਾਂ ਹਾਂਜੀ ਮੈਮ ਮੰਡੇ ਨੂੰ ਕਿੰਨੇ ਵਜੇ ਠੀਕ ਹੈ ਮੈਮ ਇੱਕ ਚੀਜ਼ ਹੋਰ ਪੁੱਛਣਾ ਚਾਹਵਾਂਗੀ ਆਪਣੀ ਸਕੂਲ ਦੀ ਇੰਟ ਟਾਈਮਿੰਗ ਮਤਲਬ ਤੁਹਾਡੇ ਸਕੂਲ ਦੀ ਟਾਈਮਿੰਗ ਕਿੰਨੀ ਰਹੇਗੀ ਅਤੇ ਮੈਮ ਮੰਥਲੀ ਆਪਾਂ ਹਾਂਜੀ ਮੈਮ ਮੈਂ ਫੁਲ ਟਾਈਮ ਫੁਲ ਟਾਈਮ ਹੀ ਜੋਆਇਨ ਕਰਨਾ ਚਾਹੁੰਦੀ ਹਾਂ ਹਾਂਜੀ ਮੈਮ ਮੈਂ ਇੱਥੇ ਡੀ ਏ ਵੀ ਸਕੂਲ ਬੁਢਲਾਢਾ ਵਿੱਚ ਪੜ੍ਹਾਇਆ ਹੋਇਆ ਹੈਗਾ ਪਲੱਸ ਵਨ ਪਲੱਸ ਟੂ ਨੂੰ ਉੱਥੇ ਮੈਂ ਦੋ ਸਾਲ ਟੀਚ ਕੀਤਾ ਆਫ਼ਟਰ ਐੱਮ ਐੱਸ ਸੀ

ਠੀਕ ਹੈ ਮੈਮ ਅਤੇ ਆਉਣਾ ਤੁਹਾਡੇ ਆੱਫਿਸ ਦੇ ਵਿੱਚ ਹੀ ਹੈ ਠੀਕ ਹੈ ਮੈਮ ਧੰਨਵਾਦ